ਸਤਿ ਸ਼੍ਰੀ ਅਕਾਲ ਜੀ ਵੈਸੇ ਤਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਹੀ ਜ਼ਿਆਦਾ ਚਿੱਤਰ ਬਣਾਏ ਹਨ ਪਰ ਜਦੋਂ ਮੇਰੇ ਸਕੂਲ ਦੇ ਵਿੱਚ ਮੁਕਾਬਲਾ ਹੋਇਆ ਸੀ ਉਸ ਵੇਲੇ ਮੈਂ ਆਪਣੇ ਮਾਂ ਬਾਪ ਦੀ ਤਸਵੀਰ ਬਣਾਈ ਸੀ ਜੋ ਕਿ ਬੜੀ ਹੀ ਸੁੰਦਰ ਬਣੀ ਸੀ ਉਸ ਮੁਕਾਬਲੇ ਵਿੱਚ ਮੈਂ ਮਾਂ ਬਾਪ ਦੀ ਤਸਵੀਰ ਬਣਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਉਸ ਵੇਲੇ ਜਦੋਂ ਉਹ ਤਸਵੀਰ ਜਾ ਕੇ ਮੈਂ ਆਪਣੇ ਮੈਡਮ ਨੂੰ ਦਿਖਾਈ ਤਾਂ ਉਹਨਾਂ ਨੇ ਮੇਰੇ ਉੱਤੇ ਬਹੁਤ ਹੀ ਮਾਣ ਕੀਤਾ ਅਤੇ ਉਹਨਾਂ ਨੂੰ ਮੇਰੇ ਇਸ ਹੁਨਰ ਬਾਰੇ ਵੀ ਪਤਾ ਲੱਗਿਆ ਉਹਨਾਂ ਨੇ ਇਹ ਤਸਵੀਰ ਦੇਖ ਕੇ ਮੇਰੇ ਮਾਂ ਬਾਪ ਦੇ ਪ੍ਰਤੀ ਮੇਰੇ ਮਨ ਵਿੱਚ ਪਿਆਰ ਦਾ ਵੇਖਿਆ ਕਿ ਮੇਰੇ ਮਨ ਵਿੱਚ ਕਿੰਨਾਂ ਪਿਆਰ ਹੈ ਉਹਨਾਂ ਦੇ ਪ੍ਰਤੀ ਅਤੇ ਇਸ ਤਸਵੀਰ ਨੂੰ ਜਾ ਕੇ ਜਦੋਂ ਮੈਂ ਆਪਣੇ ਮਾਂ ਬਾਪ ਨੂੰ ਦਿਖਾਇਆ ਤਾਂ ਉਹਨਾਂ ਨੂੰ ਬੜਾ ਹੀ ਜ਼ਿਆਦਾ ਮੇਰੇ 'ਤੇ ਮਾਣ ਮਹਿਸੂਸ ਹੋਇਆ ਅਤੇ ਉਹ ਬੜੇ ਹੀ ਜ਼ਿਆਦਾ ਖੁਸ਼ ਹੋਏ ਇੱਦਾਂ ਮੈਂ ਹੋਰ ਵੀ ਕਈ ਮੁਕਾਬਲਿਆਂ ਦੇ ਵਿੱਚ ਕਈ ਤਸਵੀਰਾਂ ਬਣਾਈਆਂ ਹਨ ਇਹ ਚਿੱਤਰ ਕਲਾ ਦੇ ਵਿੱਚ ਅਸੀਂ ਆਪਣੇ ਮਨ ਭਾਵਾਂ ਨੂੰ ਪ੍ਰਗਟ ਕਰ ਸਕਦੇ ਹਾਂ ਬਿਨਾਂ ਕੁਛ ਬੋਲੇ ਬਿਨਾਂ ਕੁਛ ਲਿਖੇ ਇਸ ਤਰ੍ਹਾਂ ਮੈਨੂੰ ਇਹ ਕਲਾਕਾਰੀ ਬਹੁਤ ਜ਼ਿਆਦਾ ਪਸੰਦ ਹੈ ਅਤੇ ਮੇਰੇ ਦੋਸਤਾਂ ਨੂੰ ਵੀ ਮੇਰੀ ਕਲਾਕਾਰੀ ਬੜੀ ਜ਼ਿਆਦਾ ਪਸੰਦ ਹੈ ਧੰਨਵਾਦ